ਹੈਲੋ ਹਾਂਜੀ ਮੈਂ ਨਾ ਅਮਨਪ੍ਰੀਤ ਬੋਲਦੀ ਹਾਂ ਜੀ ਮੈਂ ਨਾ ਹਿਮਾਚਲ ਪ੍ਰਦੇਸ਼ ਤੋਂ ਹਾਂ ਅਤੇ ਮੈਨੇ ਮੈਂ ਪਟਿਆਲਾ ਦੇ ਵਿੱਚ ਆਈ ਸੀਗੀ ਘੁੰਮਣ ਫਿਰਨ ਲਈ ਅਤੇ ਮੈਨੂੰ ਪਟਿਆਲਾ ਦੇ ਵਿੱਚ ਧੰਨਵਾਦ ਜੀ ਅਤੇ ਮੈਂ ਪਟਿਆਲਾ ਦੇ ਵਿੱਚ ਪਾਰਕ ਦੇ ਵਿੱਚ ਜਾਣਾ ਚਾਹੁੰਦੀ ਸੀ ਕੋਈ ਪਾਰਕ ਦੱਸੋ ਮੈਨੂੰ ਪਟਿਆਲੇ ਦੇ ਵਿੱਚ ਜਿੱਥੇ ਕਿ ਮੈਂ ਜਾ ਸਕਦੀ ਹਾਂ ਠੀਕ ਹੈ ਜੀ ਇਹ ਕੋਈ ਠੀਕ ਹੈ ਜੀ ਅਤੇ ਅਤੇ ਠੀਕ ਹੈ ਜੀ ਅਤੇ ਕੋਈ ਮੇਲਾ ਵਗੈਰਾ ਵੀ ਲੱਗਦੇ ਨੇ ਇੱਥੇ ਫੁੱਲਾਂ ਨਾਲ ਰਿਲੇਟਡ ਪਾਰਕਾਂ ਦੇ ਵਿੱਚ ਠੀਕ ਹੈ ਜੀ ਠੀਕ ਹੈ ਜੀ ਠੀਕ ਠੀਕ ਹੈ ਜੀ ਅਤੇ ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਮੇਲਾ ਕਦੋਂ ਲੱਗਦਾ ਜੀ ਅਤੇ ਕਦੇ ਕਿਵੇਂ ਦਾ ਹੁੰਦਾ ਮੈਂ ਕ ਕਿਉਂਕਿ ਮੈਂ ਹੁਣ ਆਈ ਹੋਈ ਹਾਂ ਨਾ ਠੀਕ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹੋਰ ਕੋਈ ਜਗ੍ਹਾ ਹੋਵੇ ਜਿੱਥੇ ਮੈਂ ਜਾ ਸਕਦੀ ਹੋਵਾਂ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਓਕੇ ਜੀ ਓਕੇ